ਮੈਂ ਆਪਣੇ ਬੱਚੇ ਲਈ ਡਰਾਇੰਗ ਕਰਦੀ ਹਾਂ ਅਤੇ ਇੱਕ ਚਿੱਤਰਕਾਰ ਚਿੱਤਰਕਾਰੀ ਕਰਦੀ ਹਾਂ ਉਸ ਦੇ ਵਿੱਚ ਜਿਹੜਾ ਕੁਛ ਬੱਚੇ ਨੂੰ ਵਧੀਆ ਲੱਗੇ ਜਿਵੇਂ ਕਿ ਉਸ ਦੇ ਖਿਡੌਣੇ ਬਣਾਉਣੇ ਦੂਜਾ ਗੁੱਡੇ ਗੁੱਡੀਆਂ ਬਣਾਉਣੇ ਅਤੇ ਜਾਨਵਰਾਂ ਦੀਆਂ ਫੋਟੋਆਂ ਬਣਾਉਣੀਆਂ ਜਿਹੜਾ ਕਿ ਮੇਰੇ ਬੱਚੇ ਨੂੰ ਬਹੁਤ ਹੀ ਵਧੀਆ ਲੱਗਦਾ ਮੈਂ ਉਹ ਸਾਰੀ ਚਿੱਤਰਕਾਰੀ ਆਪਣੇ ਹੱਥ ਨਾਲ ਕਰਕੇ ਉਸ ਨੂੰ ਖੁਸ਼ ਕਰਦੀ ਹਾਂ ਉਸ ਦੇ ਲਈ ਕੋਈ ਥੀਮ ਜਾਂ ਕੋਈ ਸਪੈਸ਼ਲ ਵਿਸ਼ਾ ਨਹੀਂ ਹੁੰਦਾ ਉਹਨੂੰ ਬਣਾਉਣਾ ਸਿਰਫ਼ ਅਤੇ ਸਿਰਫ਼ ਮੇਰਾ ਜਿਹੜਾ ਮੇਨ ਟੀਚਾ ਹੈਗਾ ਉਹ ਹੈਗਾ ਮੇਰੀ ਗੁ ਕੁੜੀ ਨੂੰ ਖੁਸ਼ ਕਰਨਾ ਉਹ ਮੇਰੀ ਚਿੱਤਰਕਾਰੀ ਨਾਲ ਬਹੁਤ ਖੁਸ਼ ਹੁੰਦੀ ਹੈ ਅਤੇ ਮੈਂ ਉਸ ਦੇ ਲਈ ਕੁਝ ਨਾ ਕੁਝ ਕੁਝ ਨਾ ਕੁਝ ਹਮੇਸ਼ਾ ਬਣਾਉਂਦੀ ਰਹਿੰਦੀ ਹਾਂ ਜਿਹਦੇ ਕਰਕੇ ਮੇਰੀ ਚਿੱਤਰਕਾਰੀ ਵਿੱਚ ਵੀ ਉਗਾੜ ਆਇਆ ਹੈ ਅਤੇ ਮੇਰਾ ਬੱਚਾ ਵੀ ਜਿਹੜਾ ਹੈਗਾ ਹਮੇਸ਼ਾ ਖੁਸ਼ ਮਿਜਾਜ ਰਹਿੰਦਾ ਅਤੇ ਮੈਨੂੰ ਹਰ ਰੋਜ਼ ਨਵੀਆਂ ਨਵੀਆਂ ਚੀਜ਼ਾਂ ਅਤੇ ਚਿੱਤਰਕਾਰੀ ਬਣਾਉਣ ਲਈ ਕਹਿੰਦੀ ਹੈ ਅਤੇ ਮੈਂ ਉਸ ਦੇ ਲਈ ਬਣਾਉਂਦੀ ਰਹਿੰਦੀ ਹਾਂ